ਹੈਲੋ ਹਾਂਜੀ ਹਾਂ ਭਾਅ ਜੀ ਤੁਹਾਡੇ ਨਾਲ ਗੱਲ ਹੋਈ ਸੀਗੀ ਮੇਰੀ ਕਿ ਮੈਂ ਤੁਹਾਡੇ ਡਰਾਈਵਰ ਦੇ ਨਾਲ ਗੱਡੀ ਲੈ ਕੇ ਇੱਥੇ ਆਇਆ ਸੀਗਾ ਚੰਡੀਗੜ੍ਹ ਅਤੇ ਮੈਂ ਪੇਮੈਂਟ ਹੁਣ ਕਰਨੀ ਸੀਗੀ ਪੇਮੈਂਟ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰੇ ਕੋਲ ਆਨਲਾਈਨ ਐਪ ਨਹੀਂ ਹੈਗੀ ਮੇਰੇ ਅਕਾਊਂਟ ਨਾਲ ਰਿਲੇਟਡ ਨਹੀਂ ਹੈਗੀ ਜਿਹਦੇ ਕਰਕੇ ਮੈਂ ਕਿਹਾ ਸੀਗਾ ਕਿ ਮੈਂ ਤੁਹਾਨੂੰ ਕੈਸ਼ ਪੈਸੇ ਦੇ ਸਕਦਾ ਨਗਦ ਪੇਮੈਂਟ ਦਿਆਂਗਾ ਔਨਲਾਈਨ ਪੇਮੈਂਟ ਦੀ ਟ੍ਰਾਂਜੈਕਸ਼ਨ ਮੇਰੇ ਕੋਲ ਅਵੇਲੇਬਲ ਨਹੀਂ ਹੈ ਤੁਸੀਂ ਮੈਨੂੰ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਤੁਸੀਂ ਡਰਾਈਵਰ ਨੂੰ ਉੱਥੇ ਜਾ ਕੇ ਕੈਸ਼ ਪੇਮੈਂਟ ਦੇ ਦੇਣਾ ਅਤੇ ਹੁਣ ਭਾਅ ਜੀ ਤੁਹਾਡਾ ਡਰਾਈਵਰ ਜਿਹੜਾ ਹੈਗਾ ਇਹ ਮੇਰੇ ਕੋਲ ਕੈਸ਼ ਪੇਮੈਂਟ ਨਹੀਂ ਲੈ ਰਿਹਾ ਮੈਂ ਇਹਨੂੰ ਸਮਝਾਇਆ ਕਿ ਭਾਈ ਮੇਰੀ ਤੁਹਾਡੇ ਮਾਲਕ ਨਾਲ ਗੱਲ ਹੋ ਚੁੱਕੀ ਸੀਗੀ ਕੇ ਉਹਨਾਂ ਨੇ ਕਿਹਾ ਸੀਗਾ ਕੋਈ ਗੱਲ ਨਹੀਂ ਤੁਸੀਂ ਜਾ ਕੇ ਡਰਾਈਵਰ ਨਾਲ ਗੱਲ ਕਰਾ ਦਿਓ ਜਾਂ ਉਹ ਤੁਹਾਡੇ ਕੋਲੋਂ ਕੈਸ਼ ਪੇਮੈਂਟ ਲੈ ਲੇਗਾ ਔਨਲਾਈਨ ਟ੍ਰਾਂਜੈਕਸ਼ਨ ਉਹ ਆਪੇ ਕਰ ਦੇਗਾ ਤੁਸੀਂ ਉਹਨੂੰ ਕੈਸ਼ ਦੇ ਦੇਣਾ ਅਤੇ ਉਹ ਆਪੇ ਸਾਨੂੰ ਔਨਲਾਈਨ ਟ੍ਰਾਂਜੈਕਸ਼ਨ ਕਰ ਦੇਗਾ ਤੁਸੀਂ ਕੰਪਨੀ ਨੂੰ ਆਪਣੇ ਆਪ ਆਟੋ ਉਹਦੇ 'ਤੇੇ ਕਰ ਦੇਵਾਂਗੇ ਮੈਂ ਹੁਣ ਇਹਨਾਂ ਨਾਲ ਗੱਲ ਕਰ ਲਈ ਹੈ ਭਾਅ ਜੀ ਨਾਲ ਅਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲੋਂ ਕੈਸ਼ ਪੈਮੈਂਟ ਲੈ ਲਓ ਤਾਂ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਮੈਂ ਇਹਨਾਂ ਨੂੰ ਕੈਸ਼ ਪੇਮੈਂਟ ਦੇ ਦਿੰਦਾ ਬਾਕੀ ਇਹ ਆਪਣੇ ਹਿਸਾਬ ਐਡਜਸਟ ਕਰ ਲੈਣਗੇ ਤੁਸੀਂ ਦੇਖ ਲਓ ਇਹਨਾਂ ਨਾਲ ਗੱਲ ਕਰਕੇ ਕਿੱਦਾਂ ਕਰਨਾ ਕਿੱਦਾ ਨਹੀਂ ਕਰਨਾ ਮੈਂ ਕੈਸ਼ ਹੀ ਦੇ ਸਕਦਾ ਅਤੇ ਕੈਸ਼ ਹੀ ਦੇਣਾ ਮੈਂ